ਮੈਂ ਇੱਕ ਕਲਾਕਾਰ ਹਾਂ ਅਤੇ ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਪੇਂਟਿੰਗ ਬਾਰੇ ਜਾਣਕਾਰੀ ਲੈਣਾ ਪਸੰਦ ਹੈ ਮੈਂ ਬਹੁਤ ਸਾਰੇ ਕਲਾ ਕਿਰਤਾਂ ਵਿੱਚ ਗਿਆ ਹਾਂ ਕਿਉਂਕਿ ਮੈਨੂੰ ਉੱਥੇ ਜਾਣਾ ਬਹੁਤ ਪਸੰਦ ਹੈ ਉੱਥੇ ਸਾਨੂੰ ਬਹੁਤ ਸਿੱਖਣ ਨੂੰ ਮਿਲਦਾ ਹੈ ਇੱਕ ਕਲਾਕਾਰ ਹੋਣ ਕਰਕੇ ਮੈਨੂੰ ਦੂਸਰਿਆਂ ਦੀ ਕਲਾ ਦੇਖਣਾ ਅਤੇ ਉਹਦੀ ਸਿਫ਼ਤ ਕਰਨਾ ਬਹੁਤ ਪਸੰਦ ਹੈ ਪਿੱਛੇ ਜਿਹੇ ਮੈਂ ਇੰਡੀਆ ਆਰਟ ਫੇਅਰ ਜੋ ਕਿ ਸਾਡੇ ਭਾਰਤ ਦਾ ਸਭ ਤੋਂ ਵੱਡਾ ਆਰਟ ਫੇਅਰ ਹੈ ਜੋ ਕਿ ਦਿੱਲੀ ਵਿੱਚ ਹੋਇਆ ਸੀ ਉੱਥੇ ਗਿਆ ਸੀ ਉੱਥੇ ਮੈਂ ਬਹੁਤ ਸਾਰੀਆਂ ਪੇਂਟਿੰਗਾਂ ਦੇਖੀਆਂ ਅਤੇ ਮੈਨੂੰ ਉਹ ਦੇ ਕੇ ਬਹੁਤ ਖੁਸ਼ੀ ਮਿਲੀ ਅਤੇ ਇੱਕ ਜਜ਼ਬਾ ਆਇਆ ਕਿ ਇੱਕ ਦਿਨ ਮੇਰੀ ਬਣਾਈ ਹੋਈ ਪੇਂਟਿੰਗ ਵੀ ਇੱਥੇ ਹੋਵੇਗੀ ਉਹ ਆਰਟ ਫੇਅਰ ਸਾਡੇ ਭਾਰਤ ਦੇ ਨਵੀਂ ਜਨਰੇਸ਼ਨ ਅਤੇ ਕੰਟੈਮਪਰੀ ਆਰਟ ਨਾਲ ਸਥਿਤ ਸੀ ਭਾਰਤ ਦੇ ਮਸ਼ਹੂਰ ਕਲਾਕਾਰ ਜਿਵੇਂ ਅਮਰੀਲਾ ਸ਼ੇਰਗਿੱਲ ਰਾਜਾ ਰਵੀ ਵਰਮਾ ਜਾਮਿਨੀ ਰੋਏ ਤਾਇਬ ਮਹਿਤਾ ਅਤੇ ਆਰਤੀ ਸੰਦੇਰ ਜੋ ਕਿ ਭਾਰਤ ਦੇ ਬਹੁਤ ਮੰਨੇ ਧੰਨੇ ਕਲਾਕਾਰ ਹਨ ਸਾਰੇ ਆਏ ਸਨ ਅਤੇ ਉਹਨਾਂ ਦੀ ਤਸਵੀਰਾਂ ਜਿਹੜੀ ਉਹਨਾਂ ਨੇ ਪੇਂਟਿੰਗ ਬਣਾਈ ਸੀ ਉਹਨਾਂ ਦੀ ਕਲਾ ਦੇਖ ਕੇ ਸਾਰਿਆਂ ਦਾ ਹੈਰਾ ਸਾਰੇ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪੇਂਟਿੰਗ ਬਹੁਤ ਹੀ ਆਕਰਸ਼ਿਤ ਅਤੇ ਸੁੰਦਰ ਸਨ ਉਹਨਾਂ ਵਿੱਚੋਂ ਮੇਰਾ ਮੇਰੀ ਮਨਪਸੰਦ ਪੇਂਟਿੰਗ ਸੀ ਮੇਰੀ ਮਨਪਸੰਦ ਪੇਂਟਿੰਗ ਸੀ ਇੱਕ ਲੈਂਡਸਕੇਪ ਜੋ ਕਿ ਆਰਤੀ ਸੁੰਦਰ ਨ ਦੁਆਰਾ ਬਣਾਇਆ ਗਿਆ ਸੀ ਉਹ ਲੈਂਡਸਕੇਪ ਸਾਡੇ ਭਾਰਤ ਦੇ ਸਾਰੇ ਦ੍ਰਿਸ਼ ਨੂੰ ਦੱਸ ਰਿਹਾ ਸੀ ਅਤੇ ਸਾਡੇ ਸੱਭਿਆਚਾਰ ਬਾਰੇ ਦੱਸ ਰਿਹਾ ਸੀ ਮੈਨੂੰ ਉਹ ਪੇਂਟਿੰਗ ਦੇਖ ਕੇ ਬਹੁਤ ਖੁਸ਼ੀ ਮਿਲੀ ਅਤੇ ਮੈਂ ਹਰ ਵਾਰ ਕੋਸ਼ਿਸ਼ ਕਰਦਾ ਹਾਂ ਕਿ ਮੈਂ ਹਰ ਇੱਕ ਆਰਟ ਫੇਅਰ ਵਿੱਚ ਜਾਵਾਂ ਤਾਂ ਜੋ ਮੈਨੂੰ ਸਿੱਖਣ ਨੂੰ ਹੋਰ ਮਿਲੇ ਅਤੇ ਮੈਨੂੰ ਥੋੜ੍ਹਾ ਪੇਂਟਿੰਗ ਦਾ ਤਜਰਬਾ ਮਿਲੇ